ਅਜੋਕੇ ਸਮੇਂ ਵਿੱਚ ਐਲੋਪੈਥੀ ਤੋਂ ਇਲਾਵਾ ਆਯੁਰਵੇਦ ਸਿੱਧ ਅਤੇ ਹੋਮਿਓਪੈਥੀ ਦਵਾਈਆਂ ਦਾ ਸਹਾਰਾ ਲੈ ਕੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਜਿਸ ਦੇ ਨਾਲ ਟਾਈਮ ਦੀ ਬੱਚਤ ਵੀ ਹੁੰਦੀ ਹੈ ਅਤੇ ਦਵਾਈਆਂ ਦੇ ਮਾੜੇ ਪ੍ਰਭਾਵ ਤੋਂ ਬਚਿਆ ਜਾਂਦਾ ਹੈ ਇਸ ਕਾਰਨ ਅੱਜ ਜ਼ਿਆਦਾਤਰ ਲੋਕ ਆਯੁਰਵੇਦ ਸਿੱਧ ਅਤੇ ਹੋਮਿਓਪੈਥੀ ਦਵਾਈਆਂ ਨੂੰ ਪਸੰਦ ਕਰਦੇ ਹਨ ਇਸ ਦੇ ਨਾਲ ਸਰੀਰ ਉੱਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ ਅਤੇ ਲੰਬੇ ਟਾਈਮ ਲਈ ਇਸ ਦੇ ਵਿੱਚ ਜੋ ਪੁਰਾਣੀਆਂ ਬਿਮਾਰੀਆਂ ਹੈ ਉਹ ਵੀ ਪੂਰੀ ਤਰ੍ਹਾਂ ਠੀਕ ਹੋ ਜਾਂਦੀਆਂ ਨੇ ਇਸ ਕਾਰਨ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਦਾ ਸਹਾਰਾ ਲੈਣਾ ਚਾਹੀਦਾ ਹੈ ਆਯੁਰਵੇਦ ਸਿਧ ਅਤੇ ਹੋਮਿਓਪੈਥੀ ਦਵਾਈਆਂ ਬਿਲਕੁਲ ਨੈਚੁਰਲ ਮੈਡੀਸਨ ਆ ਜਿਨ੍ਹਾਂ ਦਾ ਸਰੀਰ ਉੱਪਰ ਕਿਸੇ ਵੀ ਤਰ੍ਹਾਂ ਦਾ ਮਾੜਾ ਪ੍ਰਭਾਵ ਨਹੀਂ ਪੈਂਦਾ ਆਯੁਰਵੇਦ ਪਲਾਟ ਤੋਂ ਤਿਆਰ ਕੀਤੀਆਂ ਜਾਂਦੀਆਂ ਹੈ ਹੋਮਿਓਪੈਥੀ ਵੀ ਉਸੇ ਤਰ੍ਹਾਂ ਇੱਕ ਅਸੈਂਸ ਬੇਸ ਮੈਡੀਸਨ ਹੁੰਦੀਆਂ ਨੇ ਸਿੱਧ ਦੇ ਵਿੱਚ ਕੁਝ ਐਕਸਰਸਾਈਜ ਅਤੇ ਹੋਰ ਘਰੇਲੂ ਨੁਕਸਿਆਂ ਦਾ ਮਤਲਬ